ਸਾਡੇ ਸ਼ਹਿਰ ਕੁਰਾਲੀ ਦੀਆਂ ਅੰਤਰਰਾਸ਼ਟਰੀ ਖੇਡਾਂ ਕਿ ਜੋ ਕਿ ਖੇਡ ਕੇ ਆਏ ਹਨ ਉਹ ਹਨ ਕਬੱਡੀ ਫੁੱਟਬੋਲ ਅਤੇ ਹੋਕੀ ਇਹ ਸਾਡੇ ਨੁਮਾਇਦੀਆਂ ਅਤੇ ਰ ਅੰਤਰਰਾਸ਼ਟਰੀ ਖੇਡਾਂ ਹਨ